ਜ਼ਿੰਦਗੀ ਵਿੱਚ ਕਲਾ ਦੀ ਬਹੁਤ ਅਹਿਮੀਅਤ ਹੈ ਇਹ ਸਾਨੂੰ ਅਸਲ ਵਿੱਚ ਜੀਵਨ ਜਿਉਣ ਦਾ ਢੰਗ ਦੱਸਦੀ ਹੈ ਇਹ ਸੱਭਿਆਚਾਰ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਹੈ ਮੈਂ ਤਾਂ ਸਮਝਦਾ ਹਾਂ ਕਿ ਇਸ ਤੋਂ ਬਿਨਾਂ ਜ਼ਿੰਦਗੀ ਬਹੁਤ ਅਧੂਰੀ ਹੈ ਇਹ ਸਾਡੀ ਜ਼ਿੰਦਗੀ ਵਿੱਚ ਸਾਡੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਬਹੁਤ ਮਦਦ ਕਰਦੀ ਹੈ ਇਹ ਮਨੁੱਖ ਨੂੰ ਜਾਗਰੂਕ ਕਰ ਕਰਦੀ ਹੈ ਬੱਚਿਆਂ ਵਿੱਚ ਇਸਦਾ ਜੋ ਹੋਣਾ ਬਹੁਤ ਜ਼ਰੂਰੀ ਹੈ ਕੁਝ ਬੱਚੇ ਪੜ੍ਹਨ ਵਿੱਚ ਇੰਨੇ ਹੁਸ਼ਿਆਰ ਨਹੀਂ ਹੁੰਦੇ ਪਰ ਉਹ ਦੂਜੀਆਂ ਕਲਾ ਕਿਰਤੀਆਂ ਵਿੱਚ ਬਹੁਤ ਤੇਜ਼ ਹੁੰਦੇ ਹਨ ਜਿਵੇਂ ਕਿ ਨੱਚਣ ਦੀ ਕਲਾ ਡਰਾਇੰਗ ਦੀ ਕਲਾ ਅਤੇ ਸਟੇਜਾਂ ਉੱਤੇ ਬੋਲਣ ਦੀ ਕਲਾ ਉਹਨਾਂ ਵਿੱਚ ਬਹੁਤ ਹੁੰਦੀ ਹੈ ਅਸੀਂ ਉਹਨਾਂ ਦੀਆਂ ਕਲਾਵਾਂ ਨੂੰ ਪਰਖ ਕੇ ਉਹਨਾਂ ਨੂੰ ਬਹੁਤ ਅੱਗੇ ਤੱਕ ਲਿਜਾ ਸਕਦੇ ਹਾਂ ਅਸੀਂ ਜ਼ਿੰਦਗੀ ਵਿੱਚ ਇਹ ਵੀ ਦੇਖਦੇ ਹਾਂ ਕਿ ਇੱਥੇ ਬਹੁਤ ਤਰ੍ਹਾਂ ਦੇ ਅਜਿਹੇ ਵਿਅਕਤੀ ਨੇ ਜੋ ਕਿ ਚਲਣ ਵਿੱਚ ਬਹੁਤ ਅਸਮਰੱਥ ਨੇ ਪਰ ਉਹ ਆਪਣੀ ਕਲਾ ਨਾਲ ਦੂਜਿਆਂ ਦਾ ਮਨ ਮੋਹ ਲੈਂਦੇ ਹਨ ਉਹਨਾਂ ਵਿੱਚ ਮੂਰਤੀ ਬਣਾਉਣ ਦੀ ਕਲਾ ਬਹੁਤ ਵਧੀਆ ਹੁੰਦੀ ਹੈ ਜਿਸ ਨਾਲ ਉਹ ਆਪਣੀ ਰੋਜ਼ੀ ਰੋਟੀ ਚੰਗੇ ਢੰਗ ਨਾਲ ਚਲਾ ਸਕਦੇ ਹਨ ਅੱਜ ਕੱਲ੍ਹ ਇਸ ਨੂੰ ਉਤਸਾਹਿਤ ਕਰਨ ਲਈ ਸਰਕਾਰਾਂ ਵੀ ਬਹੁਤ ਯੋਗਦਾਨ ਦੇ ਰਹੀਆਂ ਹਨ ਅਸੀਂ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਤੋਂ ਇਸਦੀ ਕੋਚਿੰਗ ਲੈ ਕੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਆਪਣਾ ਸਕਦੇ ਹਾਂ ਧੰਨਵਾਦ